ਹਾਂ ਮੈਂ ਸਾਡੇ ਘਰ ਇੱਕ ਵਾਰ ਬਹੁਤ ਹੀ ਪਹਿਲਾਂ ਵੇਸਟ ਹੋਏ ਪੁਰਾਣੇ ਕੱਲਰਸ ਐਂਡ ਕ ਕੱਪੜੇ ਦੇ ਟੁਕੜੇ 'ਤੇ ਪੇਂਟਿੰਗ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਮੈਨੂੰ ਇਸ ਵਿੱਚ ਬਹੁਤ ਹੀ ਜ਼ਿਆਦਾ ਇਨਰਸਟ ਸੀ ਇਸ ਲਈ ਮੈਂ ਕੋਸ਼ਿਸ਼ ਕੀਤੀ ਵੀ ਮੈਂ ਕੁਛ ਨਿਊ ਬਣਾ ਸਕਾਂ ਇਸ ਲਈ ਮੈਂ ਇੱਕ ਗਣੇਸ਼ ਜੀ ਦੀ ਮਤਲਬ ਚਿੱਤਰਕਾਰੀ ਉੱਤੇ ਕਰਨੀ ਸਟਾਟ ਕੀਤੀ ਪਹਿਲਾਂ ਪਹਿਲਾਂ ਮੈਨੂੰ ਲੱਗ ਰਿਹਾ ਸੀ ਵੀ ਮੇਰੇ ਤੋਂ ਨਹੀਂ ਹੋ ਰਿਹਾ ਫੇਰ ਇਸ ਤੋਂ ਬਾਅਦ ਮੈਂ ਹੌਲੀ ਹੌਲੀ ਜਦੋਂ ਸਟਾਟ ਕੀਤੀ ਤਾਂ ਆਪਣੇ ਆਪ ਬਣਦੀ ਗਈ ਅਤੇ ਇਸ ਤੋਂ ਬਾਅਦ ਫੇਰ ਮੈਂ ਉਸ 'ਚ ਸਲੈਕਟ ਕਰਕੇ ਕੱਲਰ ਭਰਨੇ ਸਟਾਟ ਕੀਤੇ ਜਿਵੇਂ ਜਿਵੇਂ ਮੈਂ ਕੱਲਰ ਭਰਨੇ ਸਟਾਟ ਕੀਤੇ ਉਸ ਮਤਲਬ ਬਹੁਤ ਹੀ ਜ਼ਿਆਦਾ ਇੰਨਟਰਸਟਿੰਗ ਅਤੇ ਸੋਹਣੀ ਲੱਗਣ ਲੱਗ ਰਹੀ ਸੀ ਪੇਂਟਿੰਗ ਇਸ ਤੋਂ ਬਾਅਦ ਮੈਂ ਉਸ ਪੇਂਟਿੰਗ ਨੂੰ ਕ ਉਸ ਪੇਨ ਜਿਸ ਕੱਪੜੇ 'ਤੇ ਮੈਂ ਉਹ ਪੇਂਟਿੰਗ ਕਰੀ ਸੀ ਉਸ ਕੱਪੜੇ ਨੂੰ ਮੈਂ ਇੱਕ ਫਰੇਮ ਦੇ ਵਿੱਚ ਜੜਾ ਕੇ ਘਰ ਵਿੱਚ ਸਜਾ ਦਿੱਤਾ ਉਹ ਬਹੁਤ ਹੀ ਜ਼ਿਆਦਾ ਸੋਹਣੀ ਲੱਗ ਰਹੀ ਸੀ